ਮੈਂ ਅੱਜ ਹੀ ਇੱਕ ਆਨਲਾਈਨ ਸਟੋਰ ਯਾਪਸੀ 'ਤੇ ਆਪਣੇ ਵਾਸਤੇ ਇੱਕ ਕੁੜਤੀ ਲੱਭ ਰਹੀ ਸੀ ਮੈਂ ਆਪਣੇ ਸ਼ਹਿਰ ਦੇ ਬਾਜ਼ਾਰ ਵੀ ਘੁੰਮੀ ਪਰ ਉੱਥੇ ਜ਼ਿਆਦਾ ਵਿਕਲਪ ਨਾ ਹੋਣ ਕਾਰਨ ਮੈਨੂੰ ਕਛ ਪਸੰਦ ਨਹੀਂ ਆਇਆ ਜੋ ਮੈਨੂੰ ਇਸ ਐਪ ਵਿੱਚ ਸਭ ਤੋਂ ਵਧੀਆ ਲੱਗਾ ਉਹ ਇਹ ਹੈ ਕਿ ਮੈਨੂੰ ਹਰ ਤਰ੍ਹਾਂ ਦੇ ਵਿਕਲਪ ਮਿਲੇ ਨਾ ਹੀ ਸਿਰਫ਼ ਕੁੜਤੀਆਂ ਵਿੱਚ ਪਰ ਸੂਟਾਂ ਜੀਨਾ ਜੈਕਟਾਂ ਬਲਕਿ ਦੁਨੀਆਂ ਭਰ ਦੇ ਬਹੁਤ ਸਾਰੇ ਕੱਪੜਿਆਂ ਵਿੱਚ ਵਿਕਲਪ ਸਨ ਮੈਨੂੰ ਹਰ ਚੀਜ਼ ਮੇਰੇ ਆਕਾਰ ਅਤੇ ਲੰਬਾਈ ਅਨੁਸਾਰ ਮਿਲ ਗਈ ਬਹੁਤ ਸਾਰੇ ਨਵੇਂ ਬਰਾਂਡ ਅਤੇ ਸਟਾਈਲਾਂ ਵਿੱਚ ਚੀਜ਼ਾਂ ਮੌਜੂਦ ਹਨ ਜੋ ਕਿ ਆਮ ਦੁਕਾਨਾਂ ਵਿੱਚ ਸ਼ਾਇਦ ਹੀ ਦਿਖਦੀਆਂ ਹੋਣੀਆਂ ਇਹ ਉਹਨਾਂ ਲਈ ਬਹੁਤ ਵਧੀਆ ਹੈ ਜੋ ਆਪਣੇ ਫੈਸ਼ਨ ਨਾਲ ਪ੍ਰਯੋਗ ਕਰਨਾ ਚਾਹੁੰਦੇ ਹਨ ਅਤਰੰਗੀ ਤੋਂ ਅਤਰੰਗੀ ਅਤੇ ਵੱਖ ਵੱਖ ਕਿਸਮਾਂ ਦੇ ਕੱਪੜੇ ਜੁੱਤੇ ਇਸ ਐਪ 'ਤੇ ਖਰੀਦਦਾਰੀ ਕਰਨ ਦਾ ਤਜ਼ੁਰਬਾ ਮੇਰਾ ਤਾਂ ਬਹੁਤ ਹੀ ਵਧੀਆ ਰਿਹਾ ਅਤੇ ਮੈਂ ਇਸ ਨੂੰ ਪੰਜ ਵਿੱਚੋਂ ਚਾਰ ਰੇਟਿੰਗ ਦੇਵਾਂਗੀ